ਇੱਕ ਜਨਵਰੀ ਦੋ ਹਜ਼ਾਰ ਪੰਜ ਇੱਕੀ ਦਸੰਬਰ ਦੋ ਹਜ਼ਾਰ ਇੱਕ ਸਤਾਰਾਂ ਜੁਲਾਈ ਦੋ ਹਜ਼ਾਰ ਪੰਦਰਾਂ ਤੇਈ ਜਨਵਰੀ ਦੋ ਹਜ਼ਾਰ ਛੇ ਛੇ ਜੂਨ ਦੋ ਹਜ਼ਾਰ ਚਾਰ